ਮੈਂ ਦੋ ਦਿਨ ਪਹਿਲਾਂ ਆਪਣੇ ਲਈ ਦੋ ਕੁੜਤੀਆਂ ਦੇ ਗਲਤੀ ਨਾਲ ਓਰਡਰ ਪਾ ਬੈਠੀ ਮੰਗਵਾਉਣੀ ਮੈਂ ਇੱਕ ਕੁੜਤੀ ਸੀ ਜਿਹੜੀ ਡਬਲ ਐਕਸ ਐਲ ਸਾਈਜ਼ ਦੀ ਸੀ ਫਿਰ ਮੈਂ ਦੇਖਿਆ ਕਿ ਮੇਰੀਆਂ ਦੋ ਕੁੜਤੀਆਂ ਦੇ ਓਡਰ ਹੋ ਗਏ ਪਰ ਓਡਰ ਮੈਂ ਕੈਸ਼ ਔਨ ਡਿਲੀਵਰੀ ਕੀਤੇ ਸੀ ਇਸ ਲਈ ਮੈਨੂੰ ਲੱਗਿਆ ਕਿ ਹੁਣ ਮੈਨੂੰ ਇੱਕ ਓਡਰ ਨੂੰ ਕੈਂਸਲ ਕਰਨਾ ਪਏਗਾ ਕਿਉਂਕਿ ਜੇ ਦੋਵੇਂ ਓਡਰ ਆਏ ਤਾਂ ਇੱਕ ਵਾਰ ਦੋਵਾਂ ਦੇ ਮੈਨੂੰ ਪੈਸੇ ਦੇਣੇ ਪੈਣਗੇ ਇਸ ਲਈ ਮੈਂ ਉਸਨੂੰ ਕੁੜਤੀ ਨੂੰ ਰੱਦ ਓਡਰ ਨੂੰ ਰੱਦ ਕਰਨ ਲਈ ਮੈਂ ਐਪ 'ਤੇ ਗਈ ਮਿਅੰਤਰਾ ਦੀ ਐਪ 'ਤੇ ਪਰ ਮੇਰੇ ਕੋਲ ਓਡਰ ਰੱਦ ਨਹੀਂ ਹੋ ਰਿਹਾ ਸੀ ਵਾਰ ਵਾਰ ਉਹ ਹੀ ਸ਼ੋ ਕਰ ਰਿਹਾ ਸੀ ਫਿਰ ਮੈਂ ਉਹਨਾਂ ਦੀ ਮਿਅੰਤਰਾ ਦੀ ਆਨਲਾਈਨ ਸਾਈਟ 'ਤੇ ਕਸਟਮਰ ਕੇਅਰ 'ਤੇ ਕਾਲ ਕੀਤੀ ਉਹਨਾਂ ਨੇ ਮੇਰੀ ਪਹਿਲੀ ਵਾਰ ਮੈਂ ਜਦੋਂ ਕਾਲ ਕੀਤਾ ਤਾਂ ਉਹਨਾਂ ਨੇ ਫੋਨ ਚੱਕਿਆ ਨਹੀਂ ਦੂਸਰੀ ਵਾਰ ਕੀਤੀ ਫਿਰ ਉਹਨਾਂ ਨੇ ਮੇਰਾ ਫੋਨ ਚੱਕ ਲਿਆ ਅਤੇ ਮੈਂ ਉਹਨਾਂ ਨੂੰ ਆਪਣੀ ਮੁਸ਼ਕਿਲ ਜਿਹੜੀ ਮੈਂ ਦੋ ਓਡਰ ਗਲਤੀ ਨਾਲ ਕਰ ਚੁੱਕੀ ਸੀ ਕਰਨਾ ਇੱਕ ਸੀ ਉਹਨਾਂ ਨਾਲ ਗੱਲ ਕੀਤੀ ਉਹਨਾਂ ਨੇ ਮੈਨੂੰ ਸਮਝਾਇਆ ਕਿ ਇਸ ਓਡਰ ਨੂੰ ਰੱਦ ਕਰਨ ਲਈ ਤੁਸੀਂ ਤੁਹਾਨੂੰ ਐਪ 'ਤੇ ਹੀ ਦੁਬਾਰਾ ਟਰਾਈ ਵਾਰ ਵਾਰ ਟਰਾਈ ਕਰਨੀ ਪਏਗੀ ਤਾਂ ਹੀ ਤੁਹਾਡਾ ਓਡਰ ਰੱਦ ਹੋਏਗਾ ਕਿਉਂਕਿ ਉਹਦਾ ਓਡਰ ਰੱਦ ਕਰਨ ਲਈ ਤੁਹਾਨੂੰ ਐਪ 'ਤੇ ਜਾ ਕੇ ਉਸੇ ਓਪਸ਼ਨ 'ਤੇ ਓਨ ਕਰਨਾ ਜਿੱਥੋਂ ਤੁਸੀਂ ਸਲੈਕਟ ਕੀਤੀ ਸੀ ਉੱਥੋਂ ਹੀ ਨੀਚੇ ਜਾ ਕੇ ਕੈਂਸਲ ਦਾ ਓਡਰ ਕੈਂਸਲ ਦੀ ਓਪਸ਼ਨ ਆਏਗੀ ਉਸਨੂੰ ਤੁਸੀਂ ਸਲੈਕਟ ਕਰਨਾ ਹੈ ਫਿਰ ਮੈਂ ਦੁਬਾਰਾ ਐਪ ਖੋਲ੍ਹੀ ਉੱਥੇ ਮੈਂ ਓਡਰ ਨੂੰ ਕੈਂਸਲ ਕਰਨ ਲਈ ਓਪਸ਼ਨ 'ਤੇ ਕਲਿੱਕ ਕੀਤਾ ਪਰ ਫਿਰ ਵੀ ਮੈਨੂੰ ਸਮਝ ਨਹੀਂ ਆਈ ਮੈਂ ਮੈਂ ਫਿਰ ਬੜੀ ਪਰੇਸ਼ਾਨ ਹੋ ਗਈ ਫਿਰ ਮੈਂ ਦੁਬਾਰਾ ਕਸਟਮਰ ਕੇਅਰ 'ਤੇ ਫੋਨ ਕੀਤਾ ਉਹਨਾਂ ਨੂੰ ਦੁਬਾਰਾ ਦੱਸਿਆ ਉਹਨਾਂ ਨੇ ਕਿਹਾ ਤੁਹਾਨੂੰ ਅਸੀਂ ਦੁਬਾਰਾ ਤੁਸੀਂ ਆਪਣੀ ਐਪ ਖੋਲ੍ਹੋ ਉਹਨਾਂ ਨੇ ਮੇਰੇ ਨਾਲ ਕਾਲ 'ਤੇ ਹੋਲਡ ਰੱਖ ਕੇ ਕਹਿੰਦੇ ਤੁਸੀਂ ਓਪਸ਼ਨ ਖੋਲ੍ਹੋ ਓਪਸ਼ਨ 'ਤੇ ਉਹਨਾਂ ਨੇ ਕਿਹਾ ਦੁਬਾਰਾ ਉਸੇ ਮਿਅੰਤਰਾ ਦੀ ਐਪ ਖੋਲ੍ਹੋ ਮਿਅੰਤਰਾ ਦੀ ਫਿਰ ਮੈਂ ਐਪ ਖੋਲ੍ਹੀ ਐਪ ਖੋਲ੍ਹ ਕੇ ਫਿਰ ਕਹਿੰਦੇ ਨੀਚੇ ਕੈਂਸਲ ਦੇ ਓਡ ਮੇਰੇ ਕੋਲ ਨਾ ਕੋਈ ਦੂਸਰੀ ਓਪਸ਼ਨ ਔਨ ਹੋ ਗਈ ਸੀ ਇਸ ਲਈ ਮੇਰੇ ਕੋਲ ਓਡਰ ਕੈਂਸਲ ਨਹੀਂ ਹੋ ਰਿਹਾ ਸੀ ਫਿਰ ਉਹਨਾਂ ਨੇ ਦੱਸਿਆ ਵੀ ਤੁਸੀਂ ਉਹਨਾਂ ਨੇ ਮੈਨੂੰ ਸਕਰੀਨ ਸ਼ੇਅਰਿੰਗ ਕੀਤੀ ਅਸੀਂ ਸਕਰੀਨ ਸ਼ੇਅਰ ਕਰ ਕੇ ਉਹਨਾਂ ਨੇ ਕਿਹਾ ਵੀ ਹਾਂ ਤੁਸੀਂ ਕੋਈ ਆਪਸ਼ਨ ਅਦਰ ਚੋਇਸ ਕਰ ਲਈ ਇਸ ਲਈ ਤੁਹਾਡੀ ਕੈਂਸਲ ਦੀ ਆਪਸ਼ਨ ਨਹੀਂ ਹੋ ਰਹੀ ਫਿਰ ਉਹਨਾਂ ਨੇ ਮੈਨੂੰ ਉਹ ਸਮਝਾਇਆ ਫਿਰ ਮੈਂ ਓਪਸ਼ਨ ਨੂੰ ਕੈਂਸਲ ਕੀਤਾ ਕੈਂਸਲ ਹੋਣ ਤੋਂ ਬਾਅਦ ਫਿਰ ਮੈਨੂੰ ਮੇਰੀ ਇੱਕ ਓਪਸ਼ਨ ਸਲੈਕਟ ਹੋ ਗਈ ਜਿਸ ਨਾਲ ਮੇਰੀ ਇੱਕ ਕੁੜਤੀ ਓਡਰ ਹੋ ਗਈ ਉਸ ਤੋਂ ਬਾਅਦ ਮੈਂ ਫਿਰ ਕੈਂਸਲ ਹੋ ਗਈ ਅਤੇ ਅਤੇ ਮੇਰਾ ਕੰਮ ਹੋ ਗਿਆ ਇੱਕ ਵਾਰ ਮੇਰੀ ਅੱਗੇ ਵੀ ਇਹੋ ਹੀ ਚੀਜ਼ਾਂ ਦਾ ਦੋ ਦਾ ਓਡਰ ਆਇਆ ਸੀ ਮੈਂ ਟੀ ਵੀ ਮੰਗਵਾਇਆ ਉਹ ਦੋ ਆਪਸ਼ਨ ਓਨ ਹੋ ਗਈਆਂ ਫਿਰ ਮੈਂ ਉਹਨੂੰ ਕੈਂਸਲ ਉਹ ਬੜੀ ਆਸਾਨੀ ਨਾਲ ਔਨ ਹੋ ਗਿਆ ਸੀ ਕਿਉਂਕਿ ਮੈਂ ਉਹਦੇ 'ਤੇ ਦੋ ਦੇ ਬੈਂਕ ਦੇ ਥਰੂ ਓਨਲਾਈਨ ਪੇਮੈਂਟ ਕੀਤੀ ਸੀ ਅਤੇ ਮੇਰੀ ਗਲਤੀ ਨਾਲ ਦੋ ਦੀ ਪੇਮੈਂਟ ਚਲੀ ਗਈ ਫਿਰ ਉਹ ਵੀ ਮੈਂ ਉਹਨਾਂ ਨਾਲ ਗੱਲ ਕੀਤੀ ਕਸਟਮਰ ਕੇਅਰ 'ਤੇ ਫਿਰ ਉਹਨਾਂ ਨੇ ਮੈਨੂੰ ਦੱਸਿਆ ਵੀ ਤੁਸੀਂ ਇਸ ਤਰ੍ਹਾਂ ਓਪਸ਼ਨ ਜਾ ਕੇ ਤੁਹਾਡੀ ਜਦੋਂ ਤੁਹਾਡਾ ਟੀ ਵੀ ਐਲ ਈ ਡੀ ਲੈ ਕੇ ਚਲੇ ਜਾਣਗੇ ਉਸ ਤੋਂ ਦੋ ਤਿੰਨ ਦਿਨਾਂ ਵਿੱਚ ਤੁਹਾਡੀ ਪੇਮੈਂਟ ਵਾਪਸ ਆ ਜਾਏਗੀ ਉਹਨਾਂ ਨੇ ਮੈਨੂੰ ਸਮਝਾਇਆ